ਮੇਰਾ ਮਨ ਪਸੰਦ ਸਥਾਨ ਸਾਡੇ ਪਿੰਡ ਦਾ ਖੇਡ ਗਰਾਊਂਡ ਹੈ ਜਿੱਥੇ ਹਰ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਹਨ ਜਿੱਥੇ ਦੌੜਨ ਲਈ ਇੱਕ ਟਰੈਕ ਬਣਿਆ ਹੋਇਆ ਹੈ ਹੋਰ ਸਵੇਰੇ ਬਹੁਤ ਸਾਰੇ ਲੋਕ ਉੱਥੇ ਦੌੜਨ ਲਈ ਆਉਂਦੇ ਹਨ ਅਤੇ ਮੈਂ ਅਤੇ ਮੇਰਾ ਮਿੱਤਰ ਸਵੇਰੇ ਚਾਰ ਵਜੇ ਦੌੜਨ ਲਈ ਜਾਂਦੇ ਹਾਂ ਕਈ ਵਾਰ ਮੇਰਾ ਮਿੱਤਰ ਨਹੀਂ ਆ ਪਾਉਂਦਾ ਤਾਂ ਮੈਂ ਕਈ ਵਾਰ ਇਕੱਲਾ ਵੀ ਗਰਾਊਂਡ ਚਲਾ ਜਾਂਦਾ ਸਾਂ ਇਸ ਗਰਾਉਂਡ ਵਿੱਚ ਬਹੁਤ ਸਾਰੀਆਂ ਹੋਰ ਖੇਡਾਂ ਵੀ ਹੁੰਦੀਆਂ ਹਨ ਅਤੇ ਪਿੰਡ ਦੇ ਨੌਜਵਾਨ ਮੁੰਡੇ ਇਹਨਾਂ ਖੇਡਾਂ ਵਿੱਚ ਹਿੱਸਾ ਲੈਂਦੇ ਹਨ ਜਿਸ ਨਾਲ ਨੌਜਵਾਨ ਮੁੰਡੇ ਨਸ਼ਿਆਂ ਤੋਂ ਦੂਰ ਰਹਿੰਦੇ ਹਨ ਜਿਸ ਨਾਲ ਉਹਨਾਂ ਦੀ ਮਾਨਸਿਕ ਅਤੇ ਸਰੀਰਕ ਸਮੱਸਿਆ ਵੀ ਦੂਰ ਹੁ ਦੂਰ ਰਹਿੰਦੀਆਂ ਹਨ ਇਹਨਾਂ ਸਭ ਕਾਰਨਾਂ ਕਰਕੇ ਮੇਰੇ ਪਿੰਡ ਦਾ ਗਰਾਉਂਡ ਮੇਰਾ ਮਨ ਪਸੰਦੀਦਾ ਹੈ